ਜਿਹੜਾ ਪੰਜਾਬ ਨੂੰ ਹੈ ਇਹ ਅੰਨ ਦੀ ਟੋਕਰੀ ਕਿਹਾ ਜਾਂਦਾ ਹੈਗਾ ਹੈ ਪੰਜਾਬ ਵਿੱਚ ਬਹੁਤ ਮਤਲਬ ਸੀਜ਼ਨ ਦੇ ਅਕੋਡਿੰਗ ਬਹੁਤ ਸਾਰੀਆਂ ਫਸਲਾਂ ਪੈਦਾ ਕੀਤੀਆਂ ਜਾਂਦੀਆਂ ਚਾਵਲ ਕਣਕ ਮੱਕੀ ਕਪਾਹ ਉਹਦੇ ਇਲਾਵਾ ਜਿੱਥੇ ਖੇਤੀ ਹੁੰਦੀ ਸੀਗੀ ਉੱਥੇ ਪਸ਼ੂ ਵੀ ਜ਼ਰੂਰ ਰੱਖੇ ਜਾਂਦੇ ਹੈਗੇ ਹੈ ਜਿਹੜਾ ਪੰਜਾਬ ਹੈਗਾ ਹੈ ਜਿਹੜਾ ਇੰਡੀਆ 'ਚ ਦੁੱਧ ਪੈਦਾ ਕਰਨ ਵਾਲੇ ਰਾਜ ਹੈ ਉਹਨਾਂ 'ਚੋਂ ਸਾਰਿਆਂ ਨਾਲੋਂ ਮੋਹਰੀ ਰਾਜਾਂ 'ਚ ਪੰਜਾਬ ਆਉਂਦਾ ਹੈਗਾ ਹੈ ਇਸ ਕਰਕੇ ਆਪਾਂ ਦੇਖ ਸਕਦੇ ਹੈਗੇ ਜਿਹੜਾ ਪੰਜਾਬ ਦੇ ਹੈਗੀ ਹੈ ਉਹਦੀ ਜਿਹੜੀ ਪੰਜਾਬ ਦੀ ਜਾਂ ਦੇਸ਼ ਦੀ ਜੀ ਡੀ ਵਿੱਚ ਪੰਜਾਬ ਦੀ ਖੇਤੀਬਾੜੀ ਅਤੇ ਪਸ਼ੂ ਪਾਲਣ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਹੈਗੇ ਹੈ